ਬਾਗਬਾਨੀ ਅਸੀਂ ਆਪਣੇ ਵਿਹੜੇ ਵਿੱਚ ਕਰਦੇ ਹਾਂ ਜਾਂ ਫਿਰ ਸਾਡੇ ਕੋਲ ਵੱਖਰਾ ਪਲਾਟ ਹੈ ਉਹਦੇ ਵਿੱਚ ਕਰਦੇ ਹਾਂ ਅਸੀਂ ਵਿਹੜੇ ਵਿੱਚ ਇੱਕ ਦੋ ਬੂਟੇ ਲੀਚੀ ਦੇ ਦੋ ਬੂਟੇ ਸੰਤਰਿਆਂ ਦੇ ਕੁਝ ਸਬਜ਼ੀ ਦੀਆਂ ਬੇਲਾਂ ਕੁਝ ਫੁੱਲ ਪੌਦੇ ਲਗਾਏ ਹੋਏ ਹਨ ਅਤੇ ਅਸੀਂ ਬੜੇ ਸ਼ੌਕ ਨਾਲ ਉਹਨਾਂ ਨੂੰ ਮੇਨਟੇਂਨ ਰੱਖਦੇ ਹਾਂ ਇੱਕ ਸਾਡੇ ਕੋਲ ਹੈ ਪਲਾਟ ਹੈ ਉਹਦੇ ਵਿੱਚ ਅਸੀਂ ਲੀਚੀ ਦਾ ਬੂਟਾ ਪਪੀਤੇ ਦਾ ਅਮਰੂਦਾਂ ਦੇ ਲਗਾਟ ਦੇ ਇੱਕ ਨਿੰਬੂ ਦਾ ਇੱਕ ਅੰਬ ਦਾ ਇੱਕ ਆਮਲੇ ਦਾ ਅਤੇ ਪੰਜ ਸੱਤ ਬੂਟੇ ਪੋਪੁਲਰਾਂ ਦੇ ਲਗਾਏ ਹੋਏ ਹਨ ਜੋ ਕਿ ਅਸੀਂ ਬੜੇ ਸ਼ੌਕ ਨਾਲ ਉਹਨਾਂ ਦੀ ਦੇਖਭਾਲ ਕਰਦੇ ਹਾਂ ਗਰਮੀਆਂ ਦੇ ਵਿੱਚ ਦੋ ਵੇਲੇ ਪਾਣੀ ਦਿੰਦੇ ਹਾਂ ਅਤੇ ਉਹਦੇ ਵਿੱਚ ਅਸੀਂ ਖਾਦ ਦਾ ਨਹੀਂ ਦੇਸੀ ਰੂੜ੍ਹੀ ਦਾ ਇਸਤੇਮਾਲ ਕਰਦੇ ਹਾਂ ਅਤੇ ਉਹਨਾਂ ਨੂੰ ਸਮੇਂ ਸਮੇਂ ਸਿਰ ਪਾਣੀ ਦੀ ਜਿਹੜੀ ਦੀ ਲੋੜ ਪੂਰਤੀ ਕਰੀਦੀ ਹੈ ਜੋ ਕਿ ਇੱਕ ਸਜਾਵਟ ਵੀ ਹੈ ਔਰ ਘਰ ਖਾਣ ਦਾ ਫਲ ਵੀ ਹੈ ਇੱਕ ਛਾਵੇਂ ਵੀ ਬੈਠ ਜਾਈਦਾ ਇੱਕ ਰੌਣਕ ਵੀ ਹੈ ਇੱਕ ਬਹੁਤ ਹੀ ਵਧੀਆ ਚੀਜ਼ ਹੈਗੀ ਏ ਅਤੇ ਇਸ ਕਰਕੇ ਮੇਰੀ ਦਿਲੋਂ ਅਪੀਲ ਹੈ ਕਿ ਹਰ ਬੰਦੇ ਨੂੰ ਆਪਣੇ ਕੋਲ ਜੇ ਕਿਸੇ ਕੋਲ ਜਗ੍ਹਾ ਹੈਗੀ ਹੈ ਤਾਂ ਹਰ ਤਰ੍ਹਾਂ ਦਾ ਇੱਕ ਇੱਕ ਫਲਦਾਰ ਬੂਟਾ ਜ਼ਰੂਰ ਲਾਇਆ ਜਾਵੇ ਔਰ ਜਿਵੇਂ ਕਿ ਨਾਕ ਹੈ ਜਿਵੇਂ ਕਿ ਗੱਗੂਗੋਸ਼ਾ ਹੈ ਜਿਵੇਂ ਕਿ ਆਲੂ ਬੁਖਾਰਾ ਹੈ ਜਿਵੇਂ ਕਿ ਆੜੂ ਹੈ ਇਹ ਸਾਰੇ ਹੀ ਮੇਰਾ ਤਾਂ ਸ਼ੌਕ ਹੈ ਫਲਦਾਰ ਇੱਕ ਇੱਕ ਬੂਟਾ ਹਰ ਇੱਕ ਆਪਣੀ ਹਵੇਲੀ ਦੇ ਵਿੱਚ ਲਾਉਣਾ ਹੈ ਔਰ ਉਹਨੂੰ ਤਿਆਰ ਕਰਨਾ ਹੈ ਕੱਲ੍ਹ ਨੂੰ ਬੱਚੇ ਖਾਣਗੇ ਅਤੇ ਯਾਦ ਕਰਨਗੇ ਔਰ ਇਹ ਇੱਕ ਸੁੰਦਰਤਾ ਦਾ ਪ੍ਰਤੀਕ ਹਨ ਇਹ ਬਾਕੀ ਸ਼ੌਕ ਦੀ ਗੱਲ ਹੈ ਜੀ ਅਤੇ ਬਾਕੀ ਬਹੁਤ ਅੱਛਾ ਕੁਝ ਸਬਜ਼ੀਆਂ ਦੇ ਪੌਦੇ ਲਗਾਏ ਹੋਏ ਹਨ ਕੁਝ ਅਸੀਂ ਫੁੱਲਾਂ ਦੇ ਲਗਾਏ ਨੇ ਇਸ ਕਰਕੇ ਇਸ ਤਰ੍ਹਾਂ ਅਸੀਂ ਆਪਣਾ ਜਿਹੜਾ ਜਿਹੜਾ ਹੈ ਉਹਨੂੰ ਅਸੀਂ ਮਤਲਬ ਬਾਗਬਾਨੀ ਵਿੱਚ ਲਿਆ ਕੇ ਰੱਖਿਆ ਹੋਇਆ ਹੈ ਠੀਕ ਹੈ ਜੀ